ਨੌਂ ਨਵੰਬਰ ਉੱਨੀ ਸੌ ਬੱਨਵੇ ਅੱਠ ਦਸੰਬਰ ਉੱਨੀ ਸੌ ਇਕੱਨਵੇ ਨੌਂ ਜਨਵਰੀ ਦੋ ਹਜ਼ਾਰ ਇੱਕ ਪੰਜ ਜਨਵਰੀ ਦੋ ਹਜ਼ਾਰ ਦੋ ਦਸ ਮਾਰਚ ਦੋ ਹਜ਼ਾਰ ਪੰਜ